ਮੇਰੇ ਦੁਆਰਾ ਇਕੱਠਾ ਕੀਤਾ ਹੋਇਆ ਸਭ ਤੋਂ ਪਹਿਲਾ ਸਿੱਕਾ ਉੱਨੀ ਸੌ ਸੰਤਾਲੀ ਦਾ ਸੀ ਜਿਸ ਸਾਲ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਹ ਸਿੱਕਾ ਆਜ਼ਾਦੀ ਤੋਂ ਪਹਿਲਾਂ ਦਾ ਹੈ ਅਤੇ ਜਿਸ ਟਾਇਮ ਅਜੇ ਵੀ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਉਸ ਸਿੱਕੇ ਉੱਤੇ ਅੰਗਰੇਜ਼ਾਂ ਦੇ ਰ ਰਾਜਾ ਅਤੇ ਉਹਨਾਂ ਦੇ ਐਮਪਾਇਰ ਬਾਰੇ ਲਿਖਿਆ ਗਿਆ ਹੈ ਅਤੇ ਉਹਨਾਂ ਦੇ ਹੀ ਰਾਜੇ ਦੀ ਸ਼ਕਲ ਛਾਪੀ ਗਈ ਹੈ ਅਤੇ ਮੇਰੇ ਵੱਲੋਂ ਇਕੱਠਾ ਕੀਤਾ ਗਿਆ ਸਭ ਤੋਂ ਪਹਿਲਾ ਸਟੈਂਪ ਵੀਹ ਉੱਨੀ ਸੌ ਸੰਤਾਲੀ ਦਾ ਹੀ ਸੀ ਉਹ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਾ ਸੀ ਉਸ ਦੇ ਉੱਤੇ ਇੱਕ ਭਾਰਤ ਦਾ ਝੰਡਾ ਜੋ ਕਿ ਸਾਡੇ ਆਜ਼ਾਦ ਕਰਨ ਤੋਂ ਬਾਅਦ ਬਣਾਇਆ ਗਿਆ ਸੀਗਾ ਅਤੇ ਇੱਕ ਹਵਾਈ ਜਹਾਜ਼ ਛਪਿਆ ਹੋਇਆ ਹੈ ਇਹ ਦੋਨੇ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਹਨ ਇਹਨਾਂ ਦੋਨਾਂ ਤੋਂ ਹੀ ਮੈਂ ਸਿੱਕੇ ਅਤੇ ਸਟੈਂਪ ਵਰਗੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਸਨ ਇਹਨਾਂ ਦੋਹਾਂ ਨੂੰ ਹੀ ਦੇਖ ਕੇ ਮੇਰਾ ਇਤਿਹਾਸ ਵਿੱਚ ਇੰਟਰਸਟ ਪਿਆ ਸੀ ਅਤੇ ਮੈਂ ਹੋਰ ਵੀ ਜ਼ਿਆਦਾ ਇਤਿਹਾਸ ਵੱਲ ਨੂੰ ਤੁਰਿਆ ਸੀ